ਇਕ ਨਵਜੰਮੇ ਬੱਚੇ ਲਈ ਉਸਦੇ ਪਹਿਲੇ ਸਾਲ ਦੇ ਦੌਰਾਨ ਕਈ ਸਾਰੀ ਰਸਮਾਂ ਕੀਤੀ ਜਾਂਦੀਆਂ ਹਨ ਜਿਵੇਂ ਕਿ ਸਭ ਤੋਂ ਪਹਿਲਾਂ ਤਾਂ ਬੱਚਾ ਜਦੋਂ ਹਸਪਤਾਲ ਵਿੱਚ ਜਨਮ ਲੈਂਦਾ ਹੈ ਉਸ ਵੇਲੇ ਬੱਚੇ ਨੂੰ ਪਹਿਲਾਂ ਤਾਂ ਗੁੜ੍ਹਤੀ ਦਿੱਤੀ ਜਾਂਦੀ ਹੈ ਗੁੜ੍ਹਤੀ ਜਿਵੇਂ ਕਿ ਉਹਦਾ ਮਾਮਾ ਉਹਦਾ ਉਹਦਾ ਭਰਾ ਉਹਦਾ ਪਿਓ ਵੀ ਦੇ ਸਕਦਾ ਹੈ ਉਸ ਤੋਂ ਬਾਅਦ ਬੱਚੇ ਦੇ ਮੂੰਹ ਨੂੰ ਗੁੜ੍ਹ ਜੀਰਾ ਲਾਇਆ ਜਾਂਦਾ ਹੈ ਉਹ ਜਦੋਂ ਕਿ ਬੱਚਾ ਘਰ ਵਿੱਚ ਜੰਮਦਾ ਹੈ ਉਦੋਂ ਮੰਨਿਆ ਜਾਂਦਾ ਹੈ ਕਿ ਘਰ ਨੂੰ ਸੂਤਕ ਲੱਗ ਜਾਂਦਾ ਹੈ ਜਿਹਦੇ ਵਿੱਚ ਤੁਸੀਂ ਥੋੜ੍ਹੇ ਦਿਨ ਲਈ ਮੰਦਰ ਨੂੰ ਬੰਦ ਕਰਕੇ ਰੱਖਣਾ ਹੁੰਦਾ ਹੈ ਮੰਦਿਰ ਵਿੱਚ ਜੋਤ ਨਹੀਂ ਜਗਾਉਣੀ ਕੋਈ ਭੋਗ ਨਹੀਂ ਲਵਾਉਣਾ ਅਤੇ ਉਸ ਤੋਂ ਬਾਅਦ ਬੱਚੇ ਨੂੰ ਨਜ਼ਰ ਤੋਂ ਬਚਾਉਣ ਲਈ ਕਾਲਾ ਟਿੱਕਾ ਵੀ ਲਾਇਆ ਜਾਂਦਾ ਹੈ ਅਤੇ ਫਿਰ ਜਦੋਂ ਬੱਚਾ ਗਿਆਰ੍ਹਾਂ ਕੁ ਦਿਨਾਂ ਦਾ ਹੋ ਜਾਏ ਅਤੇ ਬੱਚੇ ਦਾ ਚੋਲਾ ਪਾਉਣ ਦਾ ਰਸਮ ਵੀ ਕੀਤਾ ਜਾਂਦਾ ਹੈ ਚੋਲੇ ਦੀ ਰਸਮ ਵਿੱਚ ਇਸ ਵਿੱਚ ਨਾਨਕੇ ਨਵਵੇਂ ਕੱਪੜੇ ਲੈ ਕੇ ਆਉਂਦੇ ਹਨ ਬੱਚੇ ਵਾਸਤੇ ਅਤੇ ਥੋੜ੍ਹੇ ਦਿਨਾਂ ਬਾਅਦ ਬੱਚੇ ਦਾ ਮੁੰਨਨ ਵੀ ਕਰਵਾਇਆ ਜਾਂਦਾ ਹੈ ਮੁੰਨਨ ਵਿੱਚ ਬੱਚੇ ਦੇ ਸੁੱਚੀ ਝੰਡ ਲਗਵਾਈ ਜਾਂਦੀ ਹੈ ਪਹਿਲੀ ਵਾਰ ਵਾਲ ਕਟਵਾਏ ਜਾਂਦੇ ਹਨ